ਹੈਲੋ ਹੈਲੋ ਹੈਲੋ ਹਾਂਜੀ ਹਾਂਜੀ ਹਾਂਜੀ ਬੋਲੋ ਜੀ ਹਾਂਜੀ ਅੱਛਾ ਜੀ ਦੱਸੋ ਅੱਛਾ ਠੀਕ ਹੈ ਜੀ ਫਿਲ ਫਿਰ ਨਹੀਂ ਉਹ ਜਿਵੇਂ ਕੀ ਕੋਈ ਦਾਰੂ ਦੁਰੂ ਪੀਂਦੇ ਹਨ ਜਾਂ ਫਿਰ ਕੋਈ ਮੈਡੀਕਲ ਨਸ਼ਾ ਕਰਦੇ ਹਨ ਇਹ ਕਿੱਦਾਂ ਫਿਰ ਕਿਸ ਤਰ੍ਹਾਂ ਦਾ ਨਸ਼ਾ ਕਰਦੇ ਹਨ ਉਹ ਜ਼ਿਆਦਾ ਅੱਛਾ ਇੱਕ ਤਾਂ ਤੁਸੀਂ ਉਹਨਾਂ ਨੂੰ ਜਿਹਦੇ ਜਿਹੜੇ ਟਾਈਮ 'ਤੇ ਉਹ ਦਾਰੂ ਪੀਂਦੇ ਹੈ ਉਸ ਟਾਈਮ 'ਤੇ ਉਹਨਾਂ ਨੂੰ ਦਾ ਉਸਦਾ ਉਹਨਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਕਿਸੇ ਹੋਰ ਪਾਸੇ ਕੰਮ 'ਤੇ ਲਗਾਓ ਜਿਵੇਂ ਉਹਨਾਂ ਨੂੰ ਕਿਤੇ ਖੇਡ 'ਚ ਲਗਾਓ ਜਾਂ ਕਿਸੇ ਟੀ ਵੀ ਟੁਵੀ 'ਤੇ ਮਨੋਰੰਜਨ 'ਚ ਲਗਾਓ ਉਹਨਾਂ ਨੂੰ ਫਿਰ ਉਹਨਾਂ ਨੂੰ ਉਹਨਾਂ ਨੂੰ ਯੋਗੇ ਬਸ ਯੋਗਾ ਕਰਨ ਵਾਸਤੇ ਪ੍ਰੇਰਿਤ ਕਰੋ ਠੀਕ ਹੈ ਜੀ ਅਤੇ ਉਹਨਾਂ ਨੂੰ ਕਹੋ ਕਿ ਯੋਗਾ ਕਰਿਆ ਕਰੋ ਤੁਹਾਨੂੰ ਤੁਸੀਂ ਇਸ ਚੀਜ਼ ਤੋਂ ਇਸ ਰੋਗ ਤੋਂ ਬਿਮਾਰੀ ਨੂੰ ਆਪਣੇ ਆਪ ਸਰੀਰ ਤੋਂ ਦੂਰ ਕਰ ਸਕੋਗੇ ਇਹ ਨਸ਼ਾ ਇੱਕ ਕੋਹੜ ਹੈ ਇਸਨੂੰ ਤੁਸੀਂ ਜੇ ਜੇ ਉਹ ਸੱਚੀ ਛੱਡਣਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਇਸ ਚੀਜ਼ ਵਾਸਤੇ ਪ੍ਰੇਰਿਤ ਕਰੋ ਠੀਕ ਹੈ ਜੇ ਜੇ ਉਹ ਫਿਰ ਵੀ ਪ੍ਰੇਰਿਤ ਨਹੀਂ ਹੋ ਰਹੇ ਫਿਰ ਤੁਸੀਂ ਇੱਕ ਵਾਰੀ ਉਹਨਾਂ ਨੂੰ ਸਾਡੇ ਕਲੀਨਿਕ ਲੈ ਕੇ ਆਓ ਅਸੀਂ ਉਹਨਾਂ ਦੀ ਕੌਂਸਲਿੰਗ ਵਗੈਰਾ ਕਰਾਂਗੇ ਉਹਨਾਂ ਨੂੰ ਆਪਣੇ ਕੋਲ ਇੱਥੇ ਰੱਖਾਂਗੇ ਉਹਨਾਂ ਨੂੰ ਸਮਝਾਵਾਂਗੇ ਉਹਨਾਂ ਨੂੰ ਪ੍ਰੋਪਰ ਜੋ ਮੈਡੀਸਨ ਹੋਏਗੀ ਉਹ ਉਹਨਾਂ ਨੂੰ ਦੇਵਾਂਗੇ ਠੀਕ ਹੈ ਜੀ ਅਤੇ ਉਹ ਤੁਸੀਂ ਦੇਖ ਲਿਓ ਜਦੋਂ ਤੁਹਾਡੇ ਕੋਲ ਠੀਕ ਟਾਈਮ ਹੋਇਆ ਤੁਹਾਡੇ ਕੋਲ ਸਾਡਾ ਨੰਬਰ ਹੈ ਤੁਹਾਡੇ ਕੋਲ ਸਾਡੇ ਉਹਦੇ ਕਲੀਨਿਕ ਦਾ ਐਡਰੈਸ ਹੈ ਜੀ ਹਾਂਜੀ ਤੁਸੀਂ ਇਸ ਜੀ ਹਾਂਜੀ ਜੀ ਜੀ ਹਾਂਜੀ ਤੁਸੀਂ ਜਦੋਂ ਵੀ ਇੱਥੇ ਆਉਣਾ ਸਾਨੂੰ ਇੱਕ ਵਾਰੀ ਆਉਣ ਤੋਂ ਪਹਿਲਾਂ ਕੋਲ ਕਰ ਲੈਣਾ ਅਤੇ ਤੁਸੀਂ ਜਦੋਂ ਵੀ ਆ ਸਕਦੇ ਹੋ ਤੇ ਆਓ ਜ਼ਰੂਰ ਉਹਨਾਂ ਨੂੰ ਲੈ ਕੇ ਅਸੀਂ ਦਿਲ ਕੋਈ ਗੱਲ ਨਹੀਂ ਤੁਸੀਂ ਸਾਡੀ ਟਾਈਮਿੰਗ ਸਰ ਸੁਬਹਾ ਨੌਂ ਤੋਂ ਲੈ ਕੇ ਸ਼ਾਮੀ ਅੱਠ ਵਜੇ ਤੱਕ ਦੀ ਹੁੰਦੀ ਹੈ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਇਸ ਟਾਈਮ ਦੇ ਵਿੱਚ ਤੇ ਆਉਣ ਤੋਂ ਪਹਿਲਾਂ ਸਾਨੂੰ ਇੱਕ ਵਾਰੀ ਕੋਲ ਕਰ ਲੈਣਾ ਠੀਕ ਹੈ ਜੀ ਓਕੇ ਜੀ ਓਕੇ ਓਕੇ ਸਰ ਓਕੇ ਜੀ